ਵੈਸੇ ਤਾਂ ਮੇਰੇ ਤੋਂ ਕੰਮ ਕਰਦੇ ਦੌਰਾਨ ਬਹੁਤ ਸਾਰੀਆਂ ਗਲਤੀਆਂ ਹੋਈਆਂ ਹਨ ਪਰ ਜੇ ਮੈਂ ਗੱਲ ਕਰਾਂ ਤਾਂ ਮੇਰੀ ਸ ਸਭ ਤੋਂ ਵੱਡੀ ਗਲਤੀ ਜੋ ਕਿ ਮੈਨੂੰ ਯਾਦ ਹੈ ਜਦ ਮੈਂ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ ਅਤੇ ਮੈਂ ਘਰਦਿਆਂ ਨੇ ਮੈਨੂੰ ਪੰਜ ਸੌ ਰੁਪਇਆ ਦੇ ਕੇ ਸਬਜ਼ੀਆਂ ਲੈਣ ਲਈ ਭੇਜਿਆ ਜਿਸ ਵਿੱਚੋਂ ਮੈਂ ਹਿਸਾਬ ਵਿੱਚ ਉਲਝ ਗਿਆ ਅਤੇ ਮੈਂ ਪੰਜ ਸੌ ਦਾ ਹੀ ਨੋਟ ਉਸਨੂੰ ਦੇ ਆਇਆ ਅਤੇ ਬਾਕੀ ਬਕਾਇਆ ਲੈਣਾ ਭੁੱਲ ਗਿਆ ਜੋ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ ਜਿਸ ਕਰਕੇ ਮੇਰੇ ਘਰਦਿਆਂ ਤੋਂ ਮੈਨੂੰ ਬਹੁਤ ਜ਼ਿਆਦਾ ਸੁਣਨਾ ਪਿਆ ਅਤੇ ਇਸ ਗਲਤੀ ਤੋਂ ਮੈਂ ਸਿੱਖਿਆ ਕਿ ਕਦੀ ਵੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਹੈ ਇੱਕ ਕੰਮ ਨੂੰ ਧਿਆਨ ਨਾਲ ਕਰਨਾ ਚਾਹੀਦਾ ਹੈ ਅਤੇ ਆਪਣਾ ਮਾਇੰਡ ਬਿਲਕੁਲ ਚਲਦਾ ਰੱਖਣਾ ਚਾਹੀਦਾ ਹੈ ਕਦੇ ਵੀ ਕਿਸੇ ਵੱਲ ਧਿਆਨ ਦੇ ਕੇ ਆਪਣਾ ਹੋਸ਼ ਨਹੀਂ ਖੋਣਾ ਚਾਹੀਦਾ